ਮੈਂ ਰੋਜ਼ਾਨਾ ਕਈ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਐਪਸ ਨੂੰ ਯੂਜ ਕਰਦਾ ਹਾਂ ਜਿਨ੍ਹਾਂ ਵਿੱਚੋਂ ਪ੍ਰਮੁੱਖਤਾ ਫੇਸਬੁੱਕ ਇੰਸਟਾਗ੍ਰਾਮ ਹੈ ਇੱਥੇ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਮੈਨੂੰ ਅੰਤਰਰਾਸ਼ਟਰੀ ਖ਼ਬਰਾਂ ਜਾਂ ਦੇਸ਼ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਇੱਥੇ ਸੁਣੀਆਂ ਗਈਆਂ ਖ਼ਬਰਾਂ ਨੂੰ ਪੜ੍ਹ ਕੇ ਜਾਂ ਦੇਖ ਕੇ ਮੈਨੂੰ ਆਪਣੇ ਦੇਸ਼ ਦੇ ਉੱਤੇ ਬਹੁਤ ਗਰਵ ਹੁੰਦਾ ਹੈ ਮੈਨੂੰ ਇਹ 'ਤੇ ਖ਼ਬਰਾਂ ਪੜ੍ਹਨੀਆਂ ਬਹੁਤ ਹੀ ਵਧੀਆ ਲੱਗਦੀਆਂ ਹਨ ਇਸ ਨੂੰ ਪੜ੍ਹ ਕੇ ਦੇਖ ਕੇ ਸੁਣ ਕੇ ਮੇਰੇ ਦਿਲ ਨੂੰ ਬੜਾ ਸਕੂਨ ਮਿਲਦਾ ਹੈ ਮੇਰੀ ਜੋ ਦ੍ਰਿਸ਼ਟੀ ਹੈ ਆਪਣੇ ਦੇਸ਼ ਦੇ ਪ੍ਰਤੀ ਬਹੁਤ ਹੀ ਵਧੀਆ ਹੋ ਗਈ ਹੈ ਮੈਨੂੰ ਸ਼ੇਅਰ ਮਾਰਕੀਟ ਦਾ ਵੀ ਬਹੁਤ ਸ਼ੌਂਕ ਹੈ ਮੈਨੂੰ ਇੱਥੋਂ ਉਹ ਵੀ ਸਿੱਖਣ ਨੂੰ ਮਿਲਦਾ ਹੈ ਇੱਥੋਂ ਬਹੁਤ ਸਾਰੀਆਂ ਹੋਰ ਚੀਜ਼ਾਂ ਦਾ ਵੀ ਸਿੱਖਣ ਤੋਂ ਮਿਲਦੀਆਂ ਹਨ ਜਿਸ ਨਾਲ ਅਸੀਂ ਆਪਣਾ ਜੋ ਦਿਲ ਪਰਚਾਵਾਂ ਤਾਂ ਕਰਦੇ ਹਾਂ ਨਾਲ ਹੀ ਸਾਨੂੰ ਕੁਛ ਅੰਤਰਰਾਸ਼ਟਰੀ ਜਾਂ ਆਪਣੀਆਂ ਦੇਸ਼ ਦੀਆਂ ਖ਼ਬਰਾਂ ਸੁਣਨ ਨੂੰ ਵੀ ਮਿਲ ਜਾਂਦੀਆਂ ਹਨ